ਵੈਸੇ ਤਾਂ ਜੇ ਰੰਗਾਂ ਦੀ ਗੱਲ ਕਰੀਏ ਤਾਂ ਮੈਨੂੰ ਸਾਰੇ ਰੰਗ ਬੜੇ ਸੋਹਣੇ ਲੱਗਦੇ ਹਨ ਅਤੇ ਜੋ ਕਲਰ ਕੋਂਬੀਨੇਸ਼ਨ ਮਾਰਕਿਟ ਦੇ ਵਿੱਚ ਹੈ ਉਸ ਦੇ ਹਿਸਾਬ ਨਾਲ਼ ਮੈਂ ਸੂਟ ਤਿਆਰ ਕਰਦੀ ਹਾਂ ਕਢਾਈ ਕਰਦੀ ਹਾਂ ਬੁਣਾਈ ਕਰਦੀ ਹਾਂ ਬਾਕੀ ਇਸ ਤੋਂ ਇਲਾਵਾ ਜੋ ਕਸਟਮਰ ਨੂੰ ਪਸੰਦ ਹੈ ਕਲਰ ਉਸ ਦੇ ਹਿਸਾਬ ਨਾਲ਼ ਸੂਟ ਤਿਆਰ ਕਰਦੀ ਹਾਂ ਅਤੇ ਰੰਗਾਂ ਦੀ ਪਸੰਦ ਦੇ ਵਿੱਚ ਮੈਨੂੰ ਸਾਰੇ ਰੰਗ ਹੀ ਬਹੁਤ ਸੋਹਣੇ ਲੱਗਦੇ ਨੇ ਅਤੇ ਮੈਨੂੰ ਰੈੱਡ ਕਲਰ ਲਾਲ ਕਲਰ ਮੇਰਾ ਸਭ ਤੋਂ ਜ਼ਿਆਦਾ ਫੇਵਰਟ ਕਲਰ ਹੈ ਅਤੇ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਬਾਕੀ ਸਾਰੇ ਰੰਗ ਬਹੁਤ ਪਿਆਰੇ ਲੱਗਦੇ ਹਨ